ਪੰਜ ਅਗਸਤ ਉੱਨੀ ਸੌ ਬਾਨਵੇਂ ਚਾਰ ਜੁਲਾਈ ਉੱਨੀ ਸੌ ਅਠਤਾਲੀ ਪੰਦਰਾਂ ਜੂਨ ਉੱਨੀ ਸੌ ਬਿਆਸੀ ਦਸ ਮਾਰਚ ਉੱਨੀ ਸੌ ਸੱਠ ਪੱਚੀ ਦਸੰਬਰ ਦੋ ਹਜ਼ਾਰ ਦੋ